ਮੈਨੂੰ ਦੋ ਚੀਜ਼ਾਂ ਹਨ ਜਿਨ੍ਹਾਂ ਤੋਂ ਐਲਰਜੀ ਹੈਗੀ ਹੈ ਪਹਿਲੀ ਜਿਸ ਤਰ੍ਹਾਂ ਜਿਵੇਂ ਕੋਈ ਤੇਲ ਸੜ ਰਿਹਾ ਸਰ੍ਹੋਂ ਦਾ ਤੇਲ ਮੈਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਹ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀਆਂ ਅਤੇ ਦੂਸਰੀ ਹੈਗੀ ਹੈ ਨੋਨ ਵੈੱਜ ਮਾਸਾਹਾਰੀ ਭੋਜਨ ਉਹ ਮੇਰੇ ਘਰ ਦੇ ਖਾਂਦੇ ਹਨ ਅਤੇ ਮੈਨੂੰ ਉਹ ਖਾਣਾ ਪਸੰਦ ਵੀ ਨਹੀਂ ਅਤੇ ਮੈਨੂੰ ਪਚਦਾ ਵੀ ਨਹੀਂ ਉਹ ਖਾਣਾ ਮੈਨੂੰ ਖਾਣ ਵਿੱਚ ਭਾਰਾ ਲੱਗਦਾ ਮੈਨੂੰ ਖਾ ਕੇ ਭਾਰਾਪਨ ਮਹਿਸੂਸ ਹੁੰਦਾ ਪਰ ਮੇਰੇ ਘਰ ਦੇ ਖਾਂਦੇ ਹਨ ਜਿਹਦੇ ਕਰਕੇ ਮੈਨੂੰ ਘਰ ਬਣਾਉਣਾ ਵੀ ਪੈਂਦਾ ਉਨ੍ਹਾਂ ਨੂੰ ਦੇਣਾ ਵੀ ਪੈਂਦਾ ਮਾਸਾਹਾਰੀ ਭੋਜਨ ਦੇ ਵਿੱਚ ਕੋਈ ਇਸ਼ੂ ਤਾਂ ਨਹੀਂ ਹੈਗਾ ਕਿ ਵੀ ਨਹੀਂ ਬਣਨਾ ਚਾਹੀਦਾ ਜਾਂ ਕਿਉਂ ਬਣਿਆ ਠੀਕ ਹੈ ਜਿਹੜਾ ਖਾਂਦਾ ਖਾਵੇ ਪਰ ਮੈਨੂੰ ਉਹ ਖਾਣਾ ਇੰਨਾਂ ਵਧੀਆ ਨਹੀਂ ਲੱਗਦਾ ਇੱਕ ਤਾਂ ਮਾਸਾਹਾਰੀ ਹੋਣ ਕਰਕੇ ਮੈਨੂੰ ਕਿਸੇ ਦੀ ਜੀਵ ਹੱਤਿਆ ਕਰਨੀ ਪਸੰਦ ਨਹੀਂ ਹੈ ਅਤੇ ਬਣਦਾ ਤਾਂ ਉਹ ਬੜੇ ਤਰੀਕਿਆਂ ਦੇ ਨਾਲ ਆ ਮਸਾਲੇ ਵਗੈਰਾ ਪਾ ਕੇ ਪਰ ਮੈਨੂੰ ਉਹਦੀ ਖੁਸ਼ਬੂ ਵੀ ਨਹੀਂ ਵਧੀਆ ਲੱਗਦੀ ਅਤੇ ਮੈਨੂੰ ਉਹ ਖਾਣਾ ਨਹੀਂ ਪਸੰਦ ਧੰਨਵਾਦ